ਸਾਡੇ ਪਿੰਡ ਦੇ ਵਿੱਚ ਪਾਣੀ ਦੇ ਵੱਖ ਵੱਖ ਸਰੋਤ ਹਨ ਜਿਵੇਂ ਕਿ ਪਾਣੀ ਦੀਆਂ ਵੱਡੀਆਂ ਵੱਡੀਆਂ ਟੈਂਕੀਆਂ ਹਰ ਇੱਕ ਗਲੀ ਦੇ ਅ ਬਾਹਰ ਲੱਗੀਆਂ ਹੋਈਆਂ ਹਨ ਤਾਂ ਜੋ ਕੋਈ ਵੀ ਦਿੱਕਤ ਪ੍ਰੇਸ਼ਾਨੀ ਆਉਣ ਦੇ ਕਾਰਨ ਲੋਕ ਆਪਣੀ ਟੈਂਕੀਆਂ ਉਸ ਦੀ ਮਦਦ ਦੇ ਨਾਲ ਭਰ ਸਕਣ ਅਤੇ ਦੂਜੇ ਪਾਸੇ ਸਰਕਾਰੀ ਟੂਟੀਆਂ ਆਉਣ ਦੇ ਪਾਣੀ ਦੇ ਆਉਣ ਨਾਲ ਹੋਰ ਵੀ ਜ਼ਿਆਦਾ ਮਦਦ ਮਿਲਦੀ ਹੈ ਲੋਕਾਂ ਨੂੰ ਕਿਉਂਕਿ ਇਹਨਾਂ ਦੇ ਉਪਲਬਧ ਹੋਣ ਨਾਲ ਲੋਕ ਆਪਣੇ ਘਰ ਦੇ ਵਿੱਚ ਪਾਣੀ ਦੀ ਸਹੂਲਤ ਨੂੰ ਤੋਂ ਨਹੀਂ ਪ੍ਰੇਸ਼ਾਨ ਹੁੰਦੇ ਅਤੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਪਾਣੀ ਭਰ ਲੈਂਦੇ ਹਨ ਜੋ ਕਿ ਇੱਕ ਬਹੁਤ ਵਧੀਆ ਤਰੀਕਾ